ਸਾਡਾ ਘਰ ਸ਼ਹਿਰ ਦੇ ਵਿੱਚੋ ਵਿੱਚ ਸਥਿਤ ਹੈ ਸਾਡੇ ਘਰ ਲਾਗੇ ਇੱਕ ਬਹੁਤ ਵੱਡਾ ਨਾਲਾ ਵੀ ਹੈਗਾ ਅਤੇ ਸਾਡੇ ਮੁਹੱਲੇ ਦੇ ਲੋਕ ਉੱਥੇ ਕੂੜਾ ਸੁੱਟਣ ਤੋਂ ਬਹੁਤ ਪਰਹੇਜ਼ ਕਰਦੇ ਹਨ ਪਰ ਜਿਹੜੇ ਲੋਕ ਬਾਹਰੋਂ ਆਉਂਦੇ ਨੇ ਉਹ ਰੋਜ਼ ਉੱਥੇ ਬਹੁਤ ਸਾਰਾ ਕੂ ਕੂੜਾ ਸੁੱਟ ਦਿੰਦੇ ਨੇ ਉਹਨਾਂ ਨੂੰ ਕਾਫੀ ਵਾਰ ਰੋਕਿਆ ਵੀ ਹੈਗਾ ਪਰ ਲੋਕ ਤਾਂ ਢੀਠ ਹੁੰਦੇ ਨੇ ਇਸ ਲਈ ਸਾਡੇ ਮੁਹੱਲੇ ਵਾਲਿਆਂ ਨੇ ਆਪਣਾ ਇੱਕ ਗਰੁੱਪ ਸ਼ੁਰੂ ਕੀਤੇ ਦਾ ਜਿਹੜਾ ਕਿ ਰੋਜ਼ ਮਤਲਬ ਕਿ ਰੋਜ਼ ਨਹੀਂ ਸੰਡੇ ਸੰਡੇ ਨੂੰ ਸਵੇਰੇ ਗਿਆਰ੍ਹਾਂ ਵਜੇ ਤੋਂ ਲੈ ਕੇ ਦੁਪਹਿਰੇ ਇੱਕ ਵਜੇ ਤੱਕ ਆਪਣੇ ਆਸ ਪਾਸ ਦੇ ਇਲਾਕਿਆਂ ਵਿੱਚ ਕੂੜਾ ਸੁੱਟਣ ਵਾਲਿਆਂ ਨੂੰ ਫੜਦਾ ਵੀ ਹੈਗਾ ਅਤੇ ਕੂੜੇ ਨੂੰ ਸਾਫ ਵੀ ਕਰਦਾ ਹੈਗਾ ਉਹ ਜਿਹੜਾ ਕੂੜਾ ਹੁੰਦਾ ਉਹ ਆਪਾਂ ਦੇਖਣੇ ਹਾਂ ਕਿ ਸੁੱਕਾ ਹੈ ਕਿ ਗਿੱਲਾ ਸੁੱਕਾ ਕੂੜਾ ਮਤਲਬ ਕਿ ਜਿਹੜੇ ਪਲਾਸਟਿਕ ਵਗੈਰਾ ਚੀਜ਼ਾਂ ਹੁੰਦੀਆਂ ਜਿਨ੍ਹਾਂ ਨੂੰ ਜ਼ਮੀਨ ਵਿੱਚ ਗਾੜ ਕੇ ਆਪਾਂ ਖਾਦ ਨਹੀਂ ਬਣਾ ਸਕਦੇ ਉਹ ਹੋ ਗਿਆ ਸੁੱਕਾ ਕੂੜਾ ਅਤੇ ਗਿੱਲਾ ਕੂੜਾ ਹੁੰਦਾ ਜਿਹੜਾ ਖਾਦ ਬਣ ਜਾਂਦਾ ਅਤੇ ਗਿੱਲੇ ਕੂੜੇ ਨੂੰ ਆਪਾਂ ਇੱਕ ਸਾਈਡ ਕਰਕੇ ਸੁੱਕੇ ਕੂੜੇ ਨੂੰ ਰਿਸਾਈਕਲ ਕਰਨ ਲਈ ਭੇਜ ਦਿੰਦੇ ਹਾਂ ਜੇ ਉਹ ਰੀਸਾਈਕਲ ਹੋ ਸਕਦਾ ਠੀਕ ਹੈ ਅਤੇ ਬਾਕੀ ਚੀਜ਼ਾਂ ਇਹ ਹੋ ਗਈਆਂ ਕਿ ਨਾਲਾ ਸਾਫ ਰੱਖਣ ਲਈ ਬਹੁਤ ਚੰਗਾ ਆਪਾਂ ਚਾਰ ਬੰਦੇ ਵੀ ਲਾਏ ਜਾਣ ਜਿਨ੍ਹਾਂ ਨੂੰ ਆਪਾ ਰੋਜ਼ ਦੇ ਤਿੰਨ ਸੌ ਤਿੰਨ ਸੌ ਰੁਪਏ ਦਿੰਦੇ ਹਾਂ ਅਤੇ ਉਹ ਦੋ ਤਿੰਨ ਘੰਟੇ ਲਾ ਕੇ ਨਾਲੇ ਨੂੰ ਸਾਫ ਕਰ ਦਿੰਦੇ ਦਿੰਦੇ ਆ ਅਤੇ ਜਦੋਂ ਉਹ ਨਾਲਾ ਸਾਫ ਕਰ ਦਿੰਦੇ ਹਨ ਅਤੇ ਨਾਲਾ ਚੰਗੀ ਤਰ੍ਹਾਂ ਵਹਿੰਦਾ ਹੈ ਅਤੇ ਕੋਈ ਬਦਬੂ ਵਗੈਰਾ ਵੀ ਨਹੀਂ ਆਉਂਦੀ ਪੂਰਾ ਸਾਫ ਸੁਥਰਾ ਜ਼ਿਆਦਾ ਵੀ ਨਹੀਂ ਹੁੰਦਾ ਮਤਲਬ ਜਿ ਜਿਹੜਾ ਕੂੜਾ ਹੈਗਾ ਹੀ ਨਾਲੇ 'ਚ ਉਹ ਤਾਂ ਰਹਿਣਾ ਹੀ ਹੈ ਪਰ ਜਿੰਨਾ ਆਪਾ ਕਰ ਸਕਦੇ ਹਾਂ ਉਹ ਆਪਾਂ ਕਰ ਦਿੰਦੇ ਹਾਂ ਜਿਸ ਨਾਲ ਕਿ ਜਿਹੜੀ ਸਾਫ ਸਫਾਈ ਆ ਵਾਤਾਵਰਨ ਸਾਰਾ ਇਲਾਕੇ ਆਲੇ ਦੁਆਲੇ ਦੇ ਬਿਲਕੁਲ ਸਾਫ ਰਹਿਣ 'ਤੇ ਇੱਕ ਗੱਲ ਹੋਰ ਕਿ ਮੋਦੀ ਜੀ ਨੇ ਦੋ ਹਜ਼ਾਰ ਚੌਦ੍ਹਾਂ ਵਿੱਚ ਸਫਾਈ ਅਭਿਆਨ ਸ਼ੁਰੂ ਕੀਤਾ ਸੀ ਪਰ ਸਾਡੇ ਇਲਾਕੇ ਦੇ ਲੋਕ ਪਹਿਲਾਂ ਹੀ ਪਹਿਲੇ ਲੱਗੇ ਰਹੇ ਹੀ ਸਫਾਈ ਅਭਿਆਨ ਕਰਨ ਹਰ ਹਫਤੇ ਠੀਕ ਹੈ ਜੀ ਹੁਣ ਤੱਕ ਉਹ ਚੱਲਿਆ ਆ ਰਿਹਾ ਅਤੇ ਉਹ ਜਿਹੜੀ ਸਫਾਈ ਹੈ ਉਹਨੂੰ ਦੇਖ ਕੇ ਦਿਲ ਖੁਸ਼ ਹੋ ਜਾਂਦਾ ਕਿਉਂਕਿ ਆਪਾਂ ਨਿੱਕੀਆਂ ਨਿੱਕੀਆਂ ਚੀਜ਼ਾਂ ਕਰਦੇ ਹਾਂ ਜਿੱਦਾਂ ਕੋਈ ਇੱਧਰੋਂ ਕੂੜਾ ਜਿੰਨਾ ਕੂੜਾ ਕੋਈ ਬੱਚਾ ਚੁੱਕ ਕੇ ਲਿਆਏਗਾ ਉੱਨਾਂ ਉੱਨੀ ਉਹਨਾਂ ਨੂੰ ਟੋਫੀਆਂ ਮਿਲਣਗੀਆਂ ਇੱਦਾਂ ਬਸ ਇਸ ਤਰ੍ਹਾਂ ਹੀ ਚਲੇ ਕਰਦਾ ਸਾਰਾ ਸਿਸਟਮ